ਪੁਰਾਣੇ ਇਤਿਹਾਸ ਵਿੱਚ ਲੋਕ ਬਹੁਤ ਇਕੱਠੇ ਰਹਿੰਦੇ ਸਨ ਅਤੇ ਕਿਸੇ ਵੀ ਕੋਈ ਵੀ ਧਰਮ ਨੂੰ ਨਹੀਂ ਦੇਖਦੇ ਸਨ ਕੋਈ ਵੀ ਧਰਮ ਹਿੰਦੂ ਮੁਸਲਿਮ ਸਿੱਖ ਈਸਾਈ ਹੋਵੇ ਭਲਾ ਉਹ ਸਾਰੇ ਹੀ ਇਕੱਠੇ ਰਹਿੰਦੇ ਸਨ ਉਹ ਕਿਸੇ ਵਿੱਚ ਕੋਈ ਵੀ ਭੇਦਭਾਵ ਨਹੀਂ ਕਰਦੇ ਸੀ ਅਤੇ ਇਕੱਠੇ ਹੀ ਇੱਕ ਪਰਿਵਾਰ ਵਿੱਚ ਰਹਿ ਕੇ ਖਾਣਾ ਖਾਂਦੇ ਸਨ ਜਿਸ ਕਰਕੇ ਉਹ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ ਸੀ ਅਗਰ ਕਿਸੇ ਦੀ ਧੀ ਕਿਸੇ ਵੀ ਗਰੀਬ ਜਾਂ ਮਾਤੜ ਜੇ ਦੀ ਧੀ ਦਾ ਵਿਆਹ ਹੋਵੇ ਉਹ ਉਸ ਉਸਨੂੰ ਉਸਨੂੰ ਪੈਸੇ ਦੁੱਧ ਦੁੱਧ ਦਾਲਾਂ ਰੋਟੀ ਆਦਿ ਅਤੇ ਕੁਝ ਅਨਾਜ ਦੇ ਦਿੰਦੇ ਸਨ ਜਿਸ ਨਾਲ ਜਿਸ ਨਾਲ ਉਹ ਆਪਣੀ ਧੀ ਦਾ ਵਿਆਹ ਵਧੀਆ ਢੰਗ ਨਾਲ ਕਰ ਸਕਦੇ ਹਨ ਸਾਡੇ ਸਮਾਜ ਵਿੱਚ ਉਹਨਾਂ ਨੂੰ ਉਹਨਾਂ ਨੂੰ ਉਸ ਦੀ ਧੀ ਨੂੰ ਹੀ ਧੀ ਮਾਂ ਮਾਂ ਭੈਣ ਸਮਝਿਆ ਜਾਂਦਾ ਸੀ ਜਿਸ ਨਾਲ ਉਹ ਦੂਜੇ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝਦੇ ਸਨ ਅਤੇ ਉਹ ਕਿਸੇ ਨਾਲ ਵੀ ਫਰਕ ਨਹੀਂ ਸੀ ਕਰਦੇ ਉਹ ਮਿਲ ਜੁਲ ਕੇ ਰਹਿੰਦੇ ਸਨ